ਮੇਰਾ ਮਨਪਸੰਦ ਰਸਾਲਾ ਨਾਰੀ ਸ਼ਕਤੀ ਅਤੇ ਮਨਪਸੰਦ ਅਖਬਾਰ ਅਜੀਤ ਅਖਬਾਰ ਹੈ ਮੈਨੂੰ ਅਜੀਤ ਅਖਬਾਰ ਪੜ੍ਹਨ ਵਿੱਚ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇਸ ਵਿੱਚ ਹਰ ਤਰ੍ਹਾਂ ਦੀ ਖਬਰ ਮੈਨੂੰ ਉਪਲਬਧ ਕੀਤੀ ਜਾਂਦੀ ਹੈ ਅਤੇ ਐਤਵਾਰ ਨੂੰ ਇਸ ਵਿੱਚ ਲੜੀਵਾਰ ਜ ਕਹਾਣੀ ਵੀ ਦਿੱਤੀ ਜਾਂਦੀ ਹੈ ਜਿਹੜੀ ਕਿ ਲਗਾਤਾਰ ਚਾਰ ਪੰਜ ਹਫਤੇ ਚਲਦੀ ਹੈ ਜਿਸ ਨਾਲ਼ ਕਿ ਮੇਰਾ ਉਹਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਵੱਧ ਜਾਂਦਾ ਹੈ ਅਤੇ ਇਸ ਵਿੱਚ ਬਹੁਤ ਸਾਰੇ ਬਲੋਗਸ ਵੀ ਹੁੰਦੇ ਹਨ ਜਿਹਦੇ ਵਿੱਚ ਕਿ ਮੈਨੂੰ ਫੂਡ ਬਲੋਗਸ ਦਾ ਵੀ ਨੋਲੇਜ ਮਿਲਦੀ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਘਰੇਲੂ ਨੁਕਤੇ ਅਤੇ ਹੋਰ ਬਹੁਤ ਸਾਰੀਆਂ ਖਬਰਾਂ ਅਤੇ ਬਹੁਤ ਸਾਰੀ ਨੌਲੇਜ ਮਿਲਦੀ ਹੈ